ਹਾਂਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਖੜ੍ਹੇ ਕਿੱਥੇ ਹੈ ਜੀ ਹੁਣ ਵਧੀਆ ਜੀ ਵਧੀਆ ਚੰਗਾ ਮੈਂ ਤਾਂ ਪੁੱਛ ਰਿਹਾ ਵੀ ਤੁਸੀਂ ਕਿਹੜੀ ਜਗ੍ਹਾ 'ਤੇ ਖੜ੍ਹੇ ਹੋ ਤੁਸੀਂ ਖਿਦਰਾਬਾਦ ਤੋਂ ਨਾ ਇਹ ਆਪਣਾ ਟੀ ਪੁਆਇੰਟ ਨੂੰ ਚਲੇ ਜਾਓ ਭੱਦੀ ਵਾਲਾ ਇੱਥੋਂ ਤੁਸੀਂ ਚਲੇ ਜਾਓ ਖਦਰੀ ਟੀ ਪੁਆਇੰਟ ਪਹੁੰਚੋ ਉੱਥੋਂ ਜਾਓ ਪਹਿਲਾਂ ਜਿੱਥੇ ਅੱਗੇ ਤੁਸੀਂ ਜਾਓਗੇ ਮੁੱਲਾਂਪੁਰ ਵਾਲਾ ਬੈਰੀਅਲ ਅੱਛਾ ਬੈਰੀਅਲ ਤੋਂ ਤੁਸੀਂ ਜਾਣਾ ਧਨਾਸ ਵਾਲੇ ਰੋਡ ਨੂੰ ਚਲੇ ਜਾਣਾ ਠੀਕ ਹੈ ਜੀ ਚੰਡੀਗੜ੍ਹ ਨਹੀਂ ਜਾਣਾ ਬਾਹਰੋਂ ਬਾਹਰ ਜਾਣਾ ਨਾ ਚੰਡੀਗੜ੍ਹ ਦਾ ਪੁੱਛ ਰਹੇ ਤੁਸੀਂ ਕਿ ਪੰਜਾਬ ਦਾ ਰੋਡ ਤੁਸੀਂ ਫਿਰ ਅੱਗੇ ਡੱਡੂ ਮਾਜਰਾ ਆ ਜੂਗਾ ਜੀ ਡੱਡੂ ਮਾਜਰੇ ਦੀ ਚੌਂਕ ਤੋਂ ਤੁਸੀਂ ਸੱਜੇ ਹੱਥ ਨੂੰ ਹੋ ਜਾਣਾ ਛੇ ਫੇਜ਼ ਵੱਲ ਨੂੰ ਛੇ ਫੇਜ਼ ਦੇ ਕੋਲ ਇੱਕ ਲਾਈਟਾਂ ਉੱਥੇ ਗੁਰਦੁਆਰਾ ਹੈ ਉੱਥੇ ਤੋਂ ਖੱਬੇ ਚਲੇ ਜਾਣਾ ਤੁਸੀਂ ਸਿੱਧੇ ਹੀ ਫਿਰ ਤੁਸੀਂ ਚਲੇ ਜਾਣਾ ਉਹ ਜਿਹੜਾ ਤਰਤਾਲੀ ਤੋਂ ਬੱਸ ਜਾਂਦਾ ਬੱਸ ਸਟੈਂਡ ਤੋਂ ਰੋਡ ਆਪਣਾ ਸੋਹਾਣੇ ਵੱਲ ਨੂੰ ਉੱਥੇ ਗੁਰਦੁਆਰਾ ਆਊਗਾ ਸ਼ਹੀਦਾਂ ਦਾ ਫਿਰ ਉੱਥੇ ਲਾਈਟਾਂ ਤੋਂ ਤੁਸੀਂ ਥੋੜ੍ਹਾ ਜਿਹਾ ਪਿੱਛੇ ਹੀ ਸੱਜੇ ਨੂੰ ਮੁੜ ਜਾਣਾ ਜੀ ਅੰਦਰ ਨੂੰ ਹਾਂਜੀ ਹਾਂ ਸ਼ਹੀਦਾਂ ਦਾ ਉਰਾਂ ਅਗਲੇ ਗੁਰਦੁਆਰੇ ਕੋਲ਼ ਨਹੀਂ ਜਾਣਾ ਪਿਛਲੇ ਗੁਰਦੁਆਰੇ ਤੋਂ ਉੱਥੇ ਤੋਂ ਥੋੜ੍ਹੀ ਦੂਰ ਜਾ ਕੇ ਇੱਕ ਸੱਜੇ ਨੂੰ ਮੋੜ ਮੁੜੂਗਾ ਫਿਰ ਸੱਜੇ ਨੂੰ ਮੋੜ ਮੁੜ ਜਾਣਾ ਤੁਸੀਂ ਉੱਥੇ ਉਹਦੇ ਸਾਈਡ ਨਾ ਉੱਥੇ ਉਹ ਹੈਗੇ ਆ ਕੋਟ ਆ ਇੱਕ ਛੋਟਾ ਕੋਟ ਉਹ ਕੋਟ ਦੇ ਬੈਕ ਸਾਈਡ 'ਤੇ ਹੈਗਾ ਫਿਰ ਤੁਹਾਨੂੰ ਆਪਣਾ ਐਜੁਕੇਸ਼ਨ ਬੋਰਡ ਵੈਸੇ ਵੈਸੇ ਉੱਥੇ ਤੁਸੀਂ ਤੁਹਾਨੂੰ ਕੀ ਕੰਮ ਆ ਉੱਥੇ ਜਾਣ ਤਾਂ ਕੋਈ ਦਿੰਦਾ ਨਹੀਂ ਅੰਦਰ ਵੈਸੇ ਤੁਸੀਂ ਸਟੂਡੈਂਟ ਹੋ ਕੀ ਹੋ ਹਾਂ ਉੱਥੇ ਚੈਕਿੰਗ ਬੈਕਿਗ ਤਾਂ ਬਹੁਤ ਹੁੰਦੀ ਆ ਨਾ ਅੰਦਰ ਅਸੀਂ ਬੜਾ ਉੱਥੇ ਕੁਛ ਵੀ ਸਮਾਨ ਵਗੈਰਾ ਨਾ ਲੈ ਕੇ ਜਾਣਾ ਆਪਣੇ ਕੋਲ ਕੋਈ ਐਸੀ ਫਾਲਤੂ ਠੀਕ ਹੈ ਜੀ ਓਕੇ